ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਥੋੜ੍ਹਾ ਜਿਹਾ ਕੀ ਜਿੰਨਾਂ ਤੁਸੀਂ ਕਹੋਗੇ ਜੀ ਓਨਾਂ ਹਾਜ਼ਰ ਆ ਹਾਂਜੀ ਹਾਂਜੀ ਵਰਾਇਟੀ ਤਾਂ ਜੀ ਫਰਨੀਚਰ 'ਚ ਜਿੱਦਾਂ ਹੁਣ ਮੇਜ਼ ਕੁਰਸੀਆਂ ਬੈੱਡ ਸੋਫ਼ੇ ਜੋ ਵੀ ਤੁਸੀਂ ਪਹਿਲਾਂ ਮਤਲਬ ਡਿਸੀਜ਼ਨ ਕਰ ਲਉ ਵੀ ਆਪਾਂ ਲੈਣਾ ਕਿਆ ਕਿਆ ਜੀ ਅਤੇ ਉਹਦੇ ਹਿਸਾਬ ਨਾਲ਼ ਫਿਰ ਰੇਟ ਉਹਦਾ ਹੋਜੂਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਠੀਕ ਇਹ ਜਿਹੜਾ ਡਾਇਨਿੰਗ ਸੈੱਟ ਹੈ ਜੀ ਇਹ ਤਕਰੀਬਨ ਵੀਹ ਕੁ ਹਜ਼ਾਰ ਤੋਂ ਸ਼ੁਰੂ ਹੋ ਜਾਂਦਾ ਜੀ ਅਤੇ ਹਾਂ ਛੇ ਕੁਰਸੀਆਂ ਅਤੇ ਨਾਲ਼ ਟੇਬਲ ਇਹ ਤਾਂ ਜੀ ਫਿਰ ਅਲੱਗ ਅਲੱਗ ਡਿਜ਼ਾਇਨ ਅਲੱਗ ਅਲੱਗ ਵਰਾਇਟੀ ਤੀਹ ਚਾਲ੍ਹੀ ਪੰਜਾਹ ਹਜ਼ਾਰ ਤੱਕ ਚਲ ਜਾਂਦਾ ਜੋ ਜਿੱਦਾਂ ਦਾ ਤੁਸੀਂ ਫਿਰ ਪਸੰਦ ਕਰੋਂਗੇ ਜੀ ਉਦਾਂ ਦਾ ਰੇਟ ਲੱਗਣਾ ਜੀ ਅਤੇ ਇਸੇ ਤਰ੍ਹਾਂ ਜਿੱਦਾਂ ਹੁਣ ਕੋਰਨਰ ਸੈੱਟ ਤੁਸੀਂ ਕਹਿੰਦੇ ਹੈ ਇਹਦਾ ਇਹਦਾ ਵੀ ਤੁਹਾਡੀ ਜਗ੍ਹਾ ਨਾਪ ਕੇ ਅਤੇ ਫਿਰ ਉਹ ਦੇਖ ਲੈਣੀ ਆ ਵੀ ਕਿੰਨੀਆਂ ਸੀਟਾਂ ਬਣਨੀਆਂ ਇੱਥੇ ਅਤੇ ਉਹ ਸੀਟ ਦਾ ਹਿਸਾਬ ਹੁੰਦਾ ਜੀ ਇਹ ਤਕਰੀਬਨ ਪੱਚੀ ਸੌ ਤਿੰਨ ਹਜ਼ਾਰ ਰੁਪਈਏ 'ਤੇ ਸੀਟ ਸ਼ੁਰੂ ਹੋ ਜਾਂਦੀ ਹੈ ਜੀ ਉਹ ਜਿੱਦਾਂ ਦਾ ਆਪਾਂ ਮਟੀਰੀਅਲ ਲਵਾਉਣਾ ਹੈ ਚਾਰ ਹਜ਼ਾਰ ਸੀਟ ਪੰ ਪੰਤਾਲੀ ਸੌ ਰੁਪਿਆ ਸੀਟ ਪੰਜ ਹਜ਼ਾਰ ਰੁਪਿਆ ਸੀਟ ਉਹ ਉਦਾਂ ਦਾ ਫਿਰ ਰੇਟ ਲੱਗ ਜਾਂਦਾ ਜੀ ਉਹ ਤੁਸੀਂ ਡੀਸਾਈਡ ਕਰਨਾ ਬਈ ਕਿੱਦਾਂ ਦਾ ਮਟੀਰੀਅਲ ਲਵਾਉਣਾ ਜੀ ਹਾਂਜੀ ਹਾਂਜੀ ਅਤੇ

ਹਾਂਜੀ ਹਾਂਜੀ ਹਾਂਜੀ ਉਹ ਜਿੱਦਾਂ ਜੇ ਤਾਂ ਟਾਹਲੀ ਦੀ ਲੱਕੜ ਲਾਈਏ ਜੀ ਅਤੇ ਫਿਰ ਤਾਂ ਤਕਰੀਬਨ ਉਹ ਇੱਕ ਕੁਰਸੀ ਤਿੰਨ ਕੁ ਹਜ਼ਾਰ ਪੈਂਤੀ ਸੌ ਦੀ ਚਾਰ ਹਜ਼ਾਰ ਪੈਂਤੀ ਸੌ ਦੀ ਪੈ ਜਾਣੀ ਜੀ ਅਤੇ ਜੇ ਸਾਗਬਾਨ ਦੀ ਲੱਕੜ ਲਾਈਏ ਤਾਂ ਹੋਰ ਮਹਿੰਗੀ ਹੋ ਜਾਣੀ ਜੇ ਡੇਕ ਵਗੈਰਾ ਲਾਈਏ ਤਾਂ ਸਸਤੀ ਹੋ ਜਾਣੀ ਆ ਜੀ ਇਹ ਤਕਰੀਬਨ ਤੁਸੀਂ ਪੱਚੀ ਪੱਚੀ ਤੀਹ ਕੁ ਹਜ਼ਾਰ ਦੀ ਰੇਂਜ 'ਚ ਡਾਇਨਿੰਗ ਸੈੱਟ ਠੀਕ ਜਿਹਾ ਬਣ ਜਾਂਦਾ ਜੀ ਹਾਂਜੀ ਹਾਂਜੀ ਬਸ ਔਡਰ ਦੇ ਹਿਸਾਬ ਨਾਲ਼ ਹੈ ਜੀ ਜਿੱਦਾਂ ਹੁਣ ਜੇ ਛੋਟਾ ਜਾ ਔਡਰ ਹੋਵੇ ਤਾਂ ਦੋ ਤਿੰਨ ਦਿਨ 'ਚ ਨਹੀਂ ਵੱਧ ਤੋਂ ਵੱਧ ਹਫ਼ਤੇ 'ਚ ਔਡਰ ਕਰ ਦਿਓ ਹਫ਼ਤੇ ਬਾਅਦ ਤੁਹਾਨੂੰ ਸੁਣਾਓ ਸਮਾਨ ਡਿਲੀਵਰ ਕਰ ਦੇਣਾ ਜੀ ਉਹ ਸਾਰਾ ਹੀ ਪ੍ਰਬੰਧ ਹੈਗਾ ਜੀ ਜਿੱਦਾਂ ਤੁਹਾਨੂੰ ਸਹੂਲਤ ਲੱਗੀ ਠੀਕ ਜਿੱਦਾਂ ਤੁਸੀਂ ਠੀਕ ਸਮਝਦੇ ਹੋ ਉਦਾਂ ਕਰ ਦਿਓ ਜੀ ਹਾਂਜੀ ਹਾਂਜੀ ਸਰ ਹਾਂਜੀ ਠੀਕ ਠੀਕ ਠੀਕ ਹੈ ਸਰ ਮੇਹਰਬਾਨੀ ਜੀ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ